ਅਸੀਂ ਆਪਣੀ ਸੱਭਿਆਚਾਰ ਨੂੰ ਬਚ ਸੱਭਿਆਚਾਰ ਨੂੰ ਬਚਾਉਣ ਅਤੇ ਪੰਜਾਬੀ ਭਾਸ਼ਾ ਲਈ ਬਹੁਤ ਉਪਰਾਲੇ ਕਰ ਰਹੇ ਹਾਂ ਹੁਣ ਅਸੀਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਸੱਭਿਆਚਾਰ ਸੀਗਾ ਵਿਆਹਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਸੀਗੇ ਜ ਜਾਗੋ ਕੱਢਣੀ ਸਿੱਠਣੀਆ ਗਾਉਣੀਆਂ ਕੰਗਣਾ ਖੇਡਣਾ ਗਿੱਧਾ ਭੰਗੜਾ ਮਲਵਈ ਗਿੱਧਾ ਹੁੰਦਾ ਸੀਗਾ ਅਤੇ ਇਹ ਚੀਜ਼ਾਂ ਹੁਣ ਪਹਿਲਾਂ ਬਹੁਤ ਪ੍ਰਚੱਲਤ ਤੀਆ ਹੁਣ ਅਲੋਪ ਹੁੰਦੀਆਂ ਜਾਂਦੀਆਂ ਨੇ ਪਰ ਅੱਜ ਦੇ ਪੀੜ੍ਹੀ ਨੇ ਇਹ ਚੀਜ਼ਾਂ ਨੂੰ ਦੁਬਾਰਾ ਤੋਂ ਸਾਂਭਣ ਦਾ ਯਤਨ ਕੀਤਾ ਅਤੇ ਹੁਣ ਤੋਂ ਦੁਬਾਰਾ ਤੋਂ ਫਿਰ ਇਹ ਚੀਜ਼ਾਂ ਮੁੜ ਤੋਂ ਆ ਰਹੀਆਂ ਨੇ ਜਿਵੇਂ ਹੁਣ ਵੀ ਵਿਆਹਾਂ ਦੇ ਵਿੱਚ ਇਹ ਚੀਜ਼ਾਂ ਆਮ ਹੋ ਚੁੱਕੀਆਂ ਲੋਕ ਸ਼ੌਕ ਨਾਲ ਗਿੱਧਾ ਭੰਗੜਾ ਪਾਉਂਦੇ ਨੇ ਜਾਗੋ ਕੱਢਦੇ ਨੇ ਸਿੱਠਣੀਆਂ ਗਾਉਂਦੇ ਨੇ ਨਾਨਕਾ ਮੇਲ ਆਉਂਦਾ ਦਾਦਕਾ ਮੇਲ ਆਉਂਦਾ ਦੋਨੋ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿੱਠੀਆਂ ਬੋਲੀਆਂ ਬੋਲ ਕੇ ਕਮੈਂਟ ਕਰਦੇ ਨੇ ਅਤੇ ਉਸ ਤੋਂ ਬਾਅਦ ਅਸੀਂ ਵਿਆਹਾਂ ਦੇ ਵਿੱਚ ਅ ਸਾਰੇ ਅ ਵਧੀਆ ਪ੍ਰੋਗਰਾਮ ਕਰਦੇ ਹਾਂ ਅਤੇ ਫਿਰ ਜਿਵੇਂ ਅਸੀਂ ਆਪਣੀ ਵਿਸਾਖੀ ਮਨਾਉਂਦੇ ਹਾਂ ਵਿਸਾਖੀ ਅਸੀਂ ਆਪਣੀ ਕਣਕ ਦੀ ਵਾਢੀ ਤੋਂ ਬਾਅਦ ਮਨਾਉਂਦੇ ਹਾਂ ਅਤੇ ਸਾਨੂੰ ਉਸ ਵਿੱਚ ਵੀ ਆਪਣੇ ਪੰਜਾਬੀ ਸੱਭਿਆਚਾਰ ਪੰਜਾਬੀ ਪਹਿਰਾਵਾ ਦੇਖਣ ਨੂੰ ਅਕਸਰ ਮਿਲਦਾ ਹੈ ਕਿਉਂਕਿ ਜਦੋਂ ਅਸੀਂ ਮੇਲਿਆਂ 'ਚ ਜਾਂਦੇ ਹਾਂ ਤਾਂ ਲੋਕ ਉੱਥੇ ਜ਼ਿਆਦਾਤਰ ਹੁਣ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਪਹਿਰਾਵੇ ਦੇ ਵਿੱਚ ਹੀ ਆਉਂਦੇ ਨੇ ਜਿਵੇਂ ਕਿਸੇ ਨੇ ਤ ਚਾਦਰਾ ਲਾਇਆ ਹੁੰਦਾ ਕੈਂਠਾ ਪਾਇਆ ਹੁੰਦਾ ਕੁੜੀਆਂ ਦੇ ਸੱਗੀ ਫੁੱਲ ਨੇ ਅਤੇ ਫੁਲਕਾਰੀ ਲੱਤੀ ਹੁੰਦੀ ਆ ਅਤੇ ਸਾਰੇ ਆਪਣੋ ਆਪਣੇ ਪ ਪਹਿਰਾਵੇ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਇਹ ਚੀਜ਼ਾਂ ਦਾ ਬਹੁਤ ਸ਼ੌਕ ਹੁੰਦਾ ਜਾ ਰਿਹਾ ਉਹ ਵੀ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਵੀ ਜਦੋਂ ਕਿਸੇ ਮੇਲੇ 'ਚ ਜਾਂ ਕਿਸੇ ਵਿਆਹ 'ਚ ਜਾਂਦੇ ਆ ਅੱਜ ਕੱਲ੍ਹ ਜਵਾਕ ਇੰਨੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਸੋਹਣੇ ਕੁੜਤੇ ਪਜਾਮੇ ਪਾ ਕੇ ਜਾਂਦੇ ਨੇ ਕੈਂਠੇ ਪਾ ਕੇ ਜਾਂਦੇ ਨੇ ਅਤੇ ਆਪਣੇ ਸੱਭਿਆਚਾਰ ਨੂੰ ਅਤੇ ਗੱਲ ਵੀ ਪਿਓਰ ਪੰਜਾਬੀ ਵਿੱਚ ਕਰਦੇ ਨੇ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਹੈ ਜਿੰਨਾ ਹੋ ਸਕੇ ਵੱਧੋ ਵੱਧ ਪੰਜਾਬੀ ਦੇ ਵਿੱਚ ਹੀ ਬੋਲਣਾ ਪੰਜਾਬੀ 'ਚ ਲਿਖਣਾ ਚਾਹੀਦਾ ਹੈ